ਹਾਂਜੀ ਮੈਮ ਸਤਿ ਸ਼੍ਰੀ ਅਕਾਲ ਕਿਵੇਂ ਹੋ ਵਧੀਆ ਕੀ ਕਰ ਰਹੇ ਸੀ ਅੱਛਾ ਹਾਂਜੀ ਕੀ ਸੋਚ ਰਹੇ ਸੀ ਹਾਂਜੀ ਹਾਂਜੀ ਹਾਂਜੀ ਮੈਂ ਵੀ ਗਈ ਸੀ ਕੱਲ੍ਹ ਬਾਜ਼ਾਰ ਤੁਸੀਂ ਕਿਹੜੀ ਸਾਈਡ ਗਏ ਸੀ ਮੈਂ ਗਾਂਧੀ ਚੌਂਕ ਵਾਲੀ ਸਾਈਡ ਗਈ ਸੀ ਅੱਛਾ ਅੱਛਾ ਤੁਸੀਂ ਹੋਰ ਸਾਈਡ ਹੋਵੋਗੇ ਮੈਂ ਵੀ ਜਦੋਂ ਗਈ ਤਾਂ ਉਸ ਟੈਮ ਮਤਲਬ ਮੈਂ ਨਾ ਕੱਪੜੇ ਖਰੀਦਣ ਗਈ ਸੀ ਅਤੇ ਜਦੋਂ ਮੈਂ ਮਤਲਬ ਕੱਪੜੇ ਉਹ ਬਾਹਰ ਲੈ ਕੇ ਆਈ ਖਰੀਦ ਲਏ ਜਦੋਂ ਦੁਕਾਨ ਤੋਂ ਬਾਹਰ ਆਈ ਤਾਂ ਉੱਧਰੋਂ ਇੱਕ ਬਾਈਕ ਆ ਰਹੀ ਸੀ ਮੇਰੇ ਵਿੱਚ ਵੱਜੀ ਹਾਂਜੀ ਅਤੇ ਉਹਦੇ ਕਰਕੇ ਅਤੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਉਹੀ ਤਾਂ ਗੱਲ ਆ ਮਤਲਬ ਜ਼ਿਆਦਾਤਰ ਤਾਂ ਪੈਦਲ ਸਫਰ ਹੀ ਕਰਨਾ ਚਾਹੀਦਾ ਕਿਉਂਕਿ ਉਹ ਬਾਜ਼ਾਰ ਹੈਗਾ ਵਿੱਚ ਹੁਣ ਕਈ ਮੋਟਰਸਾਈਕਲ ਲਿਆਉਂਦੇ ਕਈ ਵਾਰੀ ਹੁਣ ਦੁਕਾਨ ਦੇ ਸਾਹਮਣੇ ਮੋਟਰਸਾਈਕਲ ਖੜ੍ਹਾਤਾ ਹੈਗਾ ਅਤੇ ਉਸ ਟੈਮ ਪ੍ਰ ਪ੍ਰੋਬਲਮ ਆਉਂਦੀ ਹੈ ਅਤੇ ਜੇਕਰ ਮੇਰੇ ਸੱਟ ਵੱਜ ਜਾਂਦੀ ਤਾਂ ਕਿੰਨੀ ਵੱਡੀ ਪ੍ਰੋਬਲਮ ਹੋ ਜਾਣੀ ਸੀ ਹੂੰ ਹਾਂਜੀ ਹਾਂਜੀ ਉਹੀ ਤਾਂ ਗੱਲ ਆ ਇਹ ਇਹ ਨਹੀਂ ਨਾ ਸਮਝਦੇ ਸਮਝਦੇ ਨਹੀਂ ਨਾ ਲੋਕ ਇਹ ਨੇ ਸਮਝਦੇ ਹੋਣ ਤਾਂ ਇਹ ਪ੍ਰੋਬਲਮ ਹੀ ਨਾ ਆਵੇ ਫੇਰ ਅਸੀਂ ਸੋਚਿਆ ਵੀ ਚੱਲ ਹੁਣ ਉੱਧਰ ਦੀ ਨਹੀਂ ਵੀ ਹੋਰ ਸਾਈਡ ਵੀ ਤਾਂ ਹੋਰ ਰਸਤੇ ਵਿੱਚ ਦੀ ਆਵਾਂਗੇ ਵੀ ਇੱਧਰ ਦੀ ਨਹੀਂ ਆਉਂਦੇ ਜੇ ਸੱਟ ਫੇਟ ਵੱਜ ਜਾਂਦੀ ਤਾਂ ਵੱਡੀ ਪ੍ਰੋਬਲਮ ਹੋ ਜਾਣੀ ਸੀ ਹੂੰ ਸਲਿਊਸ਼ਨ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਐਂਈਂ ਹੁੰਦਾ ਘਰ ਮਤਲਬ ਕਈ ਵਾਰੀ ਹਾਂਜੀ ਕਈ ਵਾਰੀ ਹੁਣ ਨਾਲ ਬੱਚੇ ਵਗੈਰਾ ਵੀ ਹੁੰਦੇ ਬਜ਼ੁਰਗ ਵੀ ਹੁੰਦੇ ਆ ਅਤੇ ਉਦੋਂ ਵੀ ਔਖਾ ਹੋ ਜਾਂਦਾ ਨਾ ਤੇ ਹੂੰ ਤੇ ਤਾਂ ਹੀ ਬਸ ਹਾਂਜੀ ਹਾਂਜੀ ਗੱਡੀਆਂ ਵਾਸਤੇ ਵੀ ਅਲੱਗ ਹੁਣ ਮਤਲਬ ਸਲਿਊਸ਼ਨ ਹੋਣਾ ਚਾਹੀਦਾ ਨਾ ਵੀ ਅਤੇ ਕਈ ਕੋਈ ਗੱਡੀ ਠੱਲ੍ਹਣਾ ਚਾਹੁੰਦਾ ਤਾਂ ਉਹਦੇ ਵਾਸਤੇ ਪਾਰਕਿੰਗ ਵਗੈਰਾ ਹੋਣੀ ਚਾਹੀਦੀ ਹੈ ਵੀ ਉੱਥੇ ਉਹ ਵੀ ਉਹਨੂੰ ਪਿੱਛੇ ਹੀ ਠੱਲ੍ਹ ਕੇ ਆ ਸਕੇ ਅਗਲਾ ਬਾਕੀ ਪੈਦਲ ਹੀ ਆਉਣ ਵੀ ਉਹ ਕਾਰ ਵਗੈਰਾ ਪਿੱਛੇ ਹੀ ਠੱਲ੍ਹੀ ਹੋਵੇ

ਹਾਂਜੀ ਚਲੋ ਠੀਕ ਹੈ ਜੀ ਠੀਕ ਹੈ